ਪੇਂਡੂ ਲੋਕਾਂ ਲਈ ਕਾਨੂੰਨੀ ਸੇਵਾ ਲੈਣੀਆਂ ਜਿਹੜੀਆਂ ਕਿ ਬਹੁਤ ਮੁਸ਼ਕਲ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਕੁਝ ਪੇਂਡੂ ਲੋਕ ਜਦੋਂ ਪੁਲਿਸ ਵਾਲੇ ਜਾਂ ਵਕੀਲਾਂ ਕੋਲ ਜਾਂਦੇ ਆ ਤਾਂ ਉਹ ਉਹਨਾਂ ਨੂੰ ਘੱਟ ਪੜ੍ਹਿਆ ਲਿਖਿਆ ਸਮਝ ਕੇ ਉਹਨਾਂ ਤੋਂ ਵੱਧ ਪੈਸੇ ਲੈ ਲੈੈੈਂਦੇ ਆ ਜਿਹਦੇ ਨਾਲ ਜਿਹੜੀ ਆ ਕਰੱਪਸ਼ਨ ਜਿਹੜੀ ਆ ਦਿਨੋ ਦਿਨ ਜਿਹੜੀ ਵੱਧ ਰਹੀ ਹੈ ਕੁਛ ਐਵੇਂ ਹੁੰਦਾ ਹੈ ਕਿ ਪੇਂਡੂ ਲੋਕਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਕਿ ਉਹਨਾਂ ਦੀ ਜਿਹੜੀ ਵਕੀਲ ਦੀ ਫੀਸ ਹੈ ਜਾਂ ਉਹਨਾਂ ਦੇ ਕੰਮ ਲਈ ਕਿੰਨੇ ਪੈਸੇ ਲੱਗਣੇ ਹਨ ਉਹ ਵੱਧ ਤੋਂ ਵੱਧ ਜਿਹੜੇ ਪੈਸੇ ਆ ਉਹ ਵਕੀਲਾਂ ਨੂੰ ਦੇ ਦਿੰਦੇ ਹਨ ਕਈ ਵਾਰ ਪੁਲਿਸ ਵਾਲੇ ਉਹਨਾਂ ਨੂੰ ਘੱਟ ਪੜ੍ਹਿਆ ਲਿਖਿਆ ਸਮਝ ਕੇ ਉਹਨਾਂ ਦਾ ਕੰਮ ਜਲਦੀ ਨਹੀਂ ਕਰਦੇ ਜਿਹੜਾ ਉਹ ਵਾਰ ਵਾਰ ਉਸ ਕੰਮ ਨੂੰ ਲੇਟ ਕਰਦੇ ਜਾਂਦੇ ਆ ਜਿਨ੍ਹਾਂ ਕਰਕੇ ਉਹਨਾਂ ਦਾ ਕੰਮ ਜਿਹੜੇ ਕਦੇ ਵੀ ਸਿਰੇ ਚੜ੍ਹਦਾ ਹੀ ਨਹੀਂ ਹੈ